ਧਰਮ ਏ ਲੋਕਾਂ ਨੂੰ ਇਕੱਠਾ ਕਰਦਾ ਜਿੱਦਾਂ ਕਿ ਸਾਡਾ ਸਿੱਖੀ ਧਰਮ ਹੈ ਸਾਡੇ ਸਿੱਖੀ ਧਰਮ ਨੇ ਇਹ ਹੀ ਸਿਖਾਇਆ ਏ ਵੀ ਹੈ ਨਾ ਸਾਰੇ ਧਰਮ ਦੇ ਲੋਕਾਂ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ ਨਾ ਭਾਈਚਾਰੇ ਦੇ ਨਾਲ ਰਹਿਣਾ ਚਾਹੀਦਾ ਸਾਡੇ ਇਤਿਹਾਸਿਕ ਗੁਰਦੁਆਰਾ ਸਾਹਿਬ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਵੀ ਚਾਰ ਦਰਵਾਜ਼ੇ ਬਣਾਏ ਗਏ ਹਨ ਜਿਨ੍ਹਾਂ ਦਾ ਮਤਲਬ ਵੀ ਇਹੀ ਹੈ ਵੀ ਕਿਸੇ ਵੀ ਦਿਸ਼ਾਵਾਂ ਵਿੱਚੋ ਕੋਈ ਵੀ ਕਿਸੇ ਵੀ ਧਾਰ ਧਰਮ ਦਾ ਵਿਅਕਤੀ ਹੈ ਨਾ ਉੱਥੇ ਆ ਕੇ ਮੱਥਾ ਟੇਕ ਸਕਦਾ ਹੈ ਨਾ ਅਤੇ ਸਾਡੇ ਇ ਧਰਮ ਦੇ ਵਿੱਚ ਇਹੀ ਸਿਖਾਇਆ ਗਿਆ ਵੀ ਕੋਈ ਜਾਤ ਪਾਤ ਕੋਈ ਭੇਦ ਭਾਵ ਨਹੀਂ ਕਰਿਆ ਜਾਣਾ ਚਾਹੀਦਾ ਅਤੇ ਸਾਡੇ ਹੈ ਨਾ ਉਹਦੇ ਵਿੱਚ ਇੱਕ ਵਿਸ਼ੇਸ਼ ਤਿਉਹਾਰ ਇਹ ਹੀ ਮਨਾਇਆ ਜਾ ਸਾਡੇ ਹਰਿਮੰਦਰ ਸਾਹਿਬ ਵਿਖੇ ਦਿਵਾਲੀ ਦਾ ਤਿਉਹਾਰ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਏ ਲੋਕ ਇਹਨੂੰ ਮਨਾਉਣ ਵਾਸਤੇ ਦੂਰ ਦੂਰ ਤੋਂ ਉੱਥੇ ਇੱਕਠੇ ਹੁੰਦੇ ਹੈ ਅਜਿਹੇ ਹੈ ਨਾ ਅਤੇ ਇੱਕ ਮੌਕਾ ਇੱਦਾਂ ਦਾ ਵੀ ਮੈਂ ਆਪਣਾ ਇੱਕ ਐਕਸਪੀਰੀਐਂਸ ਸ਼ੇਅਰ ਕਰਦੀ ਹਾਂ ਵੀ ਜਦੋਂ ਵੀ ਦਿਹਾਲੀ ਦਿਵਾਲੀ ਦਾ ਤਿਉਹਾਰ ਆਉਂਦਾ ਅਤੇ ਮੈਂ ਹਰਿਮੰਦਰ ਸਾਹਿਬ ਵਿਖੇ ਅਸੀਂ ਸੁਬਾਹ ਸੁਬਾਹ ਜਾਂਦੇ ਹਾਂ ਅਤੇ ਉੱਥੇ ਜਾ ਕੇ ਮੱਥਾ ਟੇਕਦੇ ਇਸ ਤਰ੍ਹਾਂ ਅਸੀਂ ਆਪਣੇ ਦਿਵਾਲੀ ਦੇ ਤਿਉਹਾਰ ਦੀ ਸ਼ੁਰੂਆਤ ਕਰਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਹੀ ਦਿਵਾਲੀ ਦਾ ਤਿਉਹਾਰ ਮਨਾਉਣਾ ਸ਼ੁਰੂ ਕਰਦੇ